ਮਹਿੰਦਰ ਅਮਰਨਾਥ ਭਾਰਦਵਾਜ਼ ਇੱਕ ਸਾਬਕਾ ਭਾਰਤੀ ਕ੍ਰਿਕਟਰ ਕ੍ਰਿਕਟ ਵਿਸ਼ੇਲਸ਼ਕ ਅਤੇ ਅਧਿਕਾਰ ਹੈ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਪਹਿਲੇ ਕਪਤਾਨ ਲਾਲ ਅਮਰਨਾਥ ਦੇ ਪੁੱਤਰ ਹੈ ਮਹਿੰਦਰ ਸਿੰਘ ਉੱਨੀ ਸੌ ਤਰਾਸੀ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸੀ